ਹਾਂਜੀ ਕਿਵੇਂ ਹੋ ਜੀ ਹਾਂਜੀ ਵਧੀਆ ਮੈਮ

ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਮੈਮ ਨੇਚਰ ਤੋਂ ਹੀ ਸਟਾਰਟ ਕਰ ਦਿਓ ਜਿਵੇਂ ਨੇਚਰ ਜਿਵੇਂ ਹੋ ਗਿਆ ਹੈ ਨਾ ਆਪਣੇ ਗਰੀਨਰੀ ਵਗੈਰਾ ਹੋ ਗਈ ਸਾਰੇ ਨੇਚਰ 'ਚ ਆ ਨੇਚਰ 'ਚ ਆ ਜਾਂਦੀ ਆ ਸਾਰੀ ਹੈ ਨਾ ਅਤੇ ਉਹ ਮਤਲਬ ਮਤਲਬ ਕੁਦਰਤ ਕਰ ਦਿਓ ਜਿਵੇਂ ਹੁਣ ਆਲਾ ਦੁਆਲਾ ਆਪਣਾ ਹਰਿਆ ਭਰਿਆ ਹੋਣਾ ਚਾਹੀਦਾ ਹੈਗਾ ਹੈ ਨਾ ਜਿਵੇਂ ਉਹਦੇ 'ਤੇ ਕਰ ਦਿਓ ਲਿਖਣਾ ਸਟਾਰਟ ਹੈ ਨਾ ਅਤੇ ਫਿਰ ਉਸ ਤੋਂ ਬਾਅਦ ਕੀ ਆ ਜਦੋਂ ਤੁਹਾਡਾ ਲਿਖ ਕੇ ਕੰਪਲੀਟ ਹੋ ਗਿਆ ਮੇਰੀ ਵੀ ਬੁੱਕ ਹੈਗੀ ਇੱਕ ਆਪਾਂ ਦੋਵੇਂ ਫਿਰ ਇਕੱਠੇ ਹੀ ਪਬਲਿਸ਼ ਕਰਵਾ ਲਾਂਗੇ ਇਹਨਾਂ ਨੂੰ ਅਤੇ ਫਿਰ ਉਹ ਮਤਲਬ ਉਹਦੇ 'ਤੇ ਕੰਟੈਕਸਟ ਵਗੈਰਾ ਲਿਖਣੇ ਹੁੰਦੇ ਹੈਗੇ ਠੀਕ ਪੈਰਾ ਵਗੈਰਾ ਵੀ ਆਪਾਂ ਲਿਖ ਸਕਦੇ ਹਾਂ ਪੈਰਾ ਦੇ ਵਿੱਚ ਵੀ ਆਪਾਂ ਦੇ ਸਕਦੇ ਹੈਗੇ ਪੋਏਟਰੀ ਕ ਆਪਾਂ ਲਿਖ ਕੇ ਵੀ ਉਹਨੂੰ ਆਪਾਂ ਡਿਸਕ੍ਰਾਈਬ ਕਰ ਸਕਦੇ ਹੈਗੇ ਆਪਾਂ ਜੋ ਵੀ ਹੈ ਨਾ ਕੁਛ ਉਹਦੇ 'ਤੇ ਲਿਖਿਆ ਆਪਾਂ ਜੋ ਸੋਚਣਾ ਹੈਗਾ ਜਿਹਦੇ 'ਤੇ ਆਪਾਂ ਲਿਖਣਾ ਹੈਗਾ ਉਹਦੇ ਬਾਰੇ ਪੋਇਟਰੀ ਵੀ ਲਿਖ ਸਕਦੇ ਹੈਗੇ ਪੈਰਾਗਰਾਫ 'ਚ ਵੀ ਉਹਨੂੰ ਡਿਸਕ੍ਰਾਈਬ ਕਰ ਸਕਦੇ ਹਾਂ ਉਸ ਤੋਂ ਬਾਅਦ ਜਦੋਂ ਸਭ ਕੁਝ ਆਪਣੇ ਕੋਲ ਮਟੀਰੀਅਲ ਰੈਡੀ ਹੋ ਗਿਆ ਫਿਰ ਆਪਾਂ ਪਬਲਿਸ਼ ਕਰਵਾ ਦੇਵਾਂਗੇ ਜੀ ਬੁੱਕ ਆਪਣੀ ਅਤੇ ਉਹ ਹਾਂਜੀ ਹਾਂਜੀ ਹਾਂਜੀ ਬਰਡਜ਼ ਹੋ ਗਏ ਹਾਂਜੀ ਜਿਵੇਂ ਹਾਂਜੀ ਨੈਚੁਰਲ ਥਿੰਗ ਜਿਵੇਂ ਤੁਸੀਂ ਨੇਚਰ ਲਵ ਕੀਤੀ ਠੀਕ ਹੈ ਉਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਮੇਰੇ ਕੋਲ ਵੀ ਆਇਆ ਸੀ ਫਿਰ ਆਪਾਂ ਇਕੱਠੇ ਮਿਲਦੇ ਹਾਂ ਜੀ ਫਿਰ ਆਪਣੀ ਬੁੱਕ ਪਬਲਿਸ਼ਡ ਕਰਵਾਉਂਦੇ ਹਾਂ ਹਾਂਜੀ ਹਾਂਜੀ ਹਾਂਜੀ ਓਕੇ ਮੈਮ ਠੀਕ ਹੈ ਜੀ ਓਕੇ ਥੈਂਕ ਯੂ ਮੈਮ